ਹਾਈਕਿੰਗ ਕਰਨ ਲਈ ਮੇਰੀ ਮਨ ਪਸੰਦ ਜਗ੍ਹਾ ਪਹਾੜ ਹੈ ਇੱਕ ਵਾਰ ਅਸੀਂ ਸਕੂਲ ਵਿੱਚ ਟਰਿੱਪ ਗਏ ਸੀ ਉਹ ਟਰਿੱਪ ਸਾਡਾ ਜੰਮੂ ਅਤੇ ਕਸ਼ਮੀਰ ਗਿਆ ਸੀ ਉੱਥੇ ਅਸੀਂ ਉਥੇ ਦੇ ਬਰਫੀਲੇ ਪਹਾੜ ਹਰਿਆ ਭਰਿਆ ਜੰਗਲ ਅਤੇ ਸੂਰਜ ਦੀਆਂ ਨਜ਼ਾਰਾ ਬਹੁਤ ਵਧੀਆ ਸੀ ਉੱਥੇ ਮੈਂ ਬਰਫੀਲੇ ਪਹਾੜਾਂ ਉੱਤੇ ਹਾਈਕਿੰਗ ਕੀਤੀ ਅਤੇ ਮੇਰੇ ਦੋਸਤਾਂ ਦੋਸਤਾਂ ਨੇ ਵੀ ਕੀਤੀ ਅਤੇ ਉੱਥੇ ਦੇ ਸੰਘਣੇ ਜੰਗਲ ਅਤੇ ਸੂਰਜ ਚੜ੍ਹਨ ਜਾਂ ਡੁੱਬਣ ਦਾ ਨਜ਼ਾਰਾ ਬਹੁਤ ਹੀ ਵਧੀਆ ਸੀ